ਭਾਰਤ ਦੀ ਸਰਕਾਰੀ ਭਾਸ਼ਾ ਹਿੰਦੀ ਹੈ ਬਾਕੀ ਦੇਸ਼ ਵਿੱਚ ਬੋਲੀਆਂ ਜਾਣ ਵਾਲੀਆਂ ਬਹੁਤ ਸਾਰੀਆਂ ਭਾਸ਼ਾਵਾਂ ਹਨ ਗੁਜਰਾਤੀ ਮਰਾਠੀ ਮੇਵਾੜੀ ਪੰਜਾਬੀ ਰਾਜਸਥਾਨੀ ਗੁਜਰਾਤੀ ਬਹੁਤ ਸਾਰੀਆਂ ਆਮ ਭਾਸ਼ਾਵਾਂ ਹਨ ਅਤੇ ਜਿਵੇਂ ਆਪਾਂ ਭਾਸ਼ਾਈ ਭਿੰਨਤਾ ਦੀ ਗੱਲ ਕਰੀਏ ਨੌਰਥ ਈਸਟ ਵੈਸਟ ਸਾਊਥ 'ਚ ਅਲੱਗ ਅਲੱਗ ਬੋਲੀਆਂ ਜਾਂਦੀਆਂ ਨੇ ਜਿਵੇਂ ਪੰਜਾਬ ਵਿੱਚ ਪੰਜਾਬੀ ਬੋਲੀ ਜਾਂਦੀ ਹੈ ਇਸ ਤਰ੍ਹਾਂ ਸਾਰੀਆਂ ਜਿਹੜੀ ਭਾਸ਼ਾਵੀ ਭਿੰਨਤਾ ਹੈ ਇਹ ਭਿੰਨ ਭਿੰਨ ਹੈ ਇਹ ਆਪਣੀ ਸਟੇਟ ਟੂ ਸਟੇਟ ਹੈ ਜਿਵੇਂ ਪੰਜਾਬ ਵਿੱਚ ਪੰਜਾਬੀ ਬੋਲੀ ਜਾਂਦੀ ਹੈ ਹਰਿਆਣੇ ਦੇ ਵਿੱਚ ਹਰਿਆਣਵੀ ਬੋਲੀ ਜਾਂਦੀ ਹੈ ਇਸ ਕਰਕੇ ਜਿਹੜੀ ਭਾਸ਼ਾਈ ਭਿੰਨਤਾ ਹੈ ਇਹ ਹਰ ਸਟੇਟ ਟੂ ਸਟੇਟ ਭਿੰਨ ਭਿੰਨ ਹੁੰਦੀ ਹੈ ਥੈਂਕ ਯੂ